ਯੋਗਾ ਦੇ ਵਿੱਚ ਮੈਂ ਸੂਰਜ ਨਮਸਕਾਰ ਦੀ ਐਕਸਰਸਾਈਜ਼ ਬੜੀ ਦੇਰ ਤੋਂ ਕਰਦਾ ਰਿਹਾ ਹੈ ਇਸ ਤੋਂ ਪਹਿਲਾਂ ਮੇਰੇ ਗੁਟਨੇ ਗੋਡਿਆਂ ਵਿੱਚ ਦਰਦ ਥੋੜ੍ਹਾ ਥੋੜ੍ਹਾ ਰਹਿੰਦਾ ਸੀ ਜਦੋਂ ਜਦੋਂ ਜਦੋਂ ਮੈਂ ਯੋਗਾ ਅਤੇ ਸੂਰਜ ਨਮਸਕਾਰ ਦੀ ਐਕਸਾਈਜ਼ ਕਰਦਾ ਹਾਂ ਤਾਂ ਮੈਨੂੰ ਇਸ ਦਾ ਦਰਦ ਤੋਂ ਰਾਹਤ ਮਿਲਦਾ ਹੈ ਔਰ ਲੰਬੇ ਦਰਦਾ ਤੱਕ ਗੋਡਿਆਂ ਦੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਮੈਨੂੰ ਚੱਲਣ ਫਿਰਨ ਜਾਂ ਦੌੜ ਭੱਜ ਕਰਨ 'ਚ ਜ਼ਿੰਦਗੀ ਦੀ ਡੇਲੀ ਦੇ ਕੰਮ ਕਰਨ ਦੇ ਵਿੱਚ ਮੈਨੂੰ ਕੋਈ ਤਕਲੀਫ ਨਹੀਂ ਹੁੰਦੀ ਇਸ ਲਈ ਜਿਹੜਾ ਸੂਰਜ ਨਮਸਕਾਰ ਨੂੰ ਮੈਂ ਸਭ ਤੋਂ ਮਜ਼ਬੂਤ ਅੱਛੀ ਯੋਗਾ ਦੀ ਐਕਸਰਸਾਈਜ਼ ਮੰਨਦਾ ਹਾਂ ਇਸ ਦੇ ਅਲੱਗ ਅਲੱਗ ਦਸ ਤਰ੍ਹਾਂ ਦੀਆਂ ਜਿਹੜੀਆਂ ਐਕਸਰਸਾਈਜ਼ਾਂ ਹਾਂ ਉਹਨਾਂ ਦੇ ਨਾਲ ਅਲੱਗ ਅਲੱਗ ਹਿੱਸੇ ਜਿਹੜੇ ਸਾਡੇ ਸਰੀਰ ਦੇ ਹੈ ਉਹਨਾਂ ਨੂੰ ਐਨਰਜੀ ਮਿਲਦੀ ਹੈ ਮਸਲ ਮਜ਼ਬੂਤ ਹੁੰਦੇ ਹੈ ਅਤੇ ਉਸੇ ਤਰ੍ਹਾਂ ਹੀ ਇਹ ਬੈਨੀਫਿਟ ਮੈਂ ਮਹਿਸੂਸ ਵੀ ਕੀਤਾ ਹੈ ਅਤੇ ਅੱਗੇ ਵੀ ਮੈਂ ਇਸ ਨੂੰ ਜਿੱਥੋਂ ਤੱਕ ਹੋ ਸਕੇ ਕੋਸ਼ਿਸ਼ ਕਰਦਾ ਹਾਂ ਕਿ ਇਹਨੂੰ ਚਲ ਜਾਰੀ ਰੱਖਾਂ ਤਾਂ ਕਿ ਆਪਣਾ ਜੋ ਬਾਡੀ ਦਾ ਓਵਰਆਲ ਸਟਰਕਚਰ ਹੈ ਜੋ ਅਬ ਤੱਕ ਬੈਨੀਫਿਟ ਮਿਲਿਆ ਹੁਣ ਤੱਕ ਬੈਨੀਫਿਟ ਮਿਲਿਆ ਹੈ ਉਹ ਅੱਗੇ ਵੀ ਮਿਲਦਾ ਰਹੇ ਤਾਂ ਕਿ ਮੈਂ ਇਸ ਨੂੰ ਇਸਨੂੰ ਕਰਦਾ ਰਹਾਂ ਅੱਗੇ ਤੋਂ ਅੱਗੇ ਕਰਦਾ ਰਹਾਂ